ਗਜ਼ਲ ਗਾਇਕ ਸਧਾਰਨ ਗਾਇਕੀ ਨਾਲੋਂ ਬਹੁਤ ਹੀ ਵੱਖ ਹੈ ਜਿਹੜੀ ਗਜ਼ਲ ਗਾਇਕੀ ਹੈ ਉਹਦੇ ਵਿੱਚ ਠਹਿਰਾਵ ਹੈ ਉਸ 'ਚ ਦਰਦ ਹੈ ਉਸ 'ਚ ਸਕੂਨ ਹੈ ਜਿਹੜੀ ਕਿ ਦੂਸਰੇ ਗਾਣਿਆਂ ਦੇ ਵਿੱਚ ਨਹੀਂ ਮਿਲਦੀ ਦੂਸਰੇ ਗਾਣਿਆਂ ਦੇ ਵਿੱਚ ਸਿਰਫ਼ ਹੀ ਬਕਵਾਸ ਹੀ ਭਰੀ ਹੁੰਦੀ ਹੈ ਗਜ਼ਲ ਗਾ ਗਜ਼ਲ ਜਿਹੜੀ ਹੈ ਉਹ ਇੱਕ ਮੀਨਿੰਗ ਪੇਸ਼ ਕਰਦੀ ਹੈ ਉਹਦੇ ਵਿੱਚ ਇੱਕ ਸਿਚੁਏਸ਼ਨ ਹੁੰਦੀ ਹੈ ਜਿਹੜੀ ਤੁਸੀਂ ਜਿਹਦੇ ਵਿੱਚ ਤੁਸੀਂ ਰੁੜ ਜਾਂਦੇ ਹੋ ਵੱਗ ਜਾਂਦੇ ਹੋ ਅਤੇ ਜਿਹੜੀ ਗਜ਼ਲ ਗਾਇਕ ਅੱਜ ਕੱਲ੍ਹ ਬਹੁਤ ਹੀ ਵਧੀਆ ਨਹੀਂ ਆ ਰਹੇ ਪੁਰਾਣੇ ਗਜ਼ਲ ਗਾਇਕ ਬਹੁਤ ਹੀ ਵਧੀਆ ਸਨ ਜਿੱਦਾਂ ਕਿ ਜਗਜੀਤ ਸਿੰਘ ਚਿੱਤਰਾ ਸਿੰਘ ਅਤੇ ਪੰਕਜ ਉਦਾਸ ਨੁਸਰਤ ਫਤਿਹ ਅਲੀ ਖਾਨ ਇਹਨਾਂ ਦੀ ਗਾਇਕੀ ਦੇ ਵਿੱਚ ਬਹੁਤ ਠਹਿਰਾਵ ਹੈ ਉਹ ਹਮੇਸ਼ਾਂ ਹੀ ਗਜ਼ਲਾਂ ਜਿਹੜੀਆਂ ਹੁੰਦੀਆਂ ਨੇ ਉਹ ਸੀਰੀਅਸ ਦੇ ਵਿੱਚ ਗਾਈਆਂ ਜਾਂਦੀਆਂ ਨੇ ਜਦੋਂ ਵੀ ਤੁਸੀਂ ਉਦਾਸ ਹੋਵੋ ਜਾਂ ਤੁਹਾਡਾ ਮਨ ਉਦਾਸ ਹੁੰਦਾ ਹੈ ਜੇ ਤੁਸੀਂ ਗਜ਼ਲ ਗਜਲਾਂ ਸੁਣਦੇ ਹੋ ਤਾਂ ਉਹ ਤੁਹਾਡੇ ਮਨ ਨੂੰ ਛੂਹ ਜਾਂਦੀਆਂ ਹਨ ਇਹ ਤੁਹਾਨੂੰ ਸਕੂਨ ਦਿੰਦੀਆਂ ਹਨ ਇਹਦੇ ਵਿੱਚ ਬਹੁਤ ਹੀ ਸ਼ਾਂਤੀ ਮਿਲਦੀ ਹੈ ਇਹਨਾਂ ਨੂੰ ਸੁਣ ਕੇ ਇਸ ਕਰਕੇ ਗਜ਼ਲ ਦੀ ਗਜ਼ਲ ਅਤੇ ਦੂਜੇ ਗਾਣਿਆਂ ਦੇ ਵਿੱਚ ਬਹੁਤ ਅੰਤਰ ਹੈ